ਜਿਵੇਂ ਕਿ ਪਹਿਲਾਂ ਦੇ ਜ਼ਮਾਨੇ ਵਿੱਚ ਤਕਨੋਲਜੀ ਨਾ ਹੋਣ ਕਾਰਨ ਆਪਾਂ ਆਪਣਾ ਓਫ਼ਿਸ ਦਾ ਜ਼ਿਆਦਾ ਕੰਮ ਜਾਂ ਦਫਤਰਾਂ ਦਾ ਜਾਂ ਕਿਸੇ ਵੀ ਦੁਕਾਨ ਦਾ ਵੀ ਕੋਈ ਕੰਮ ਹੁੰਦਾ ਸੀ ਇੱਕ ਵਹੀ ਖਾਤਾ ਫਾਈਲ ਉੱਤੇ ਕਰਦੇ ਸੀ ਵਹੀ ਖਾਤਾ ਕੋਪੀ ਉੱਤੇ ਲਿਖਦੇ ਸੀਗੇ ਪਰ ਜਿਵੇਂ ਕਿ ਅੱਜ ਕੱਲ੍ਹ ਕੰਪਿਊਟਰ ਆ ਚੁੱਕੇ ਹਨ ਉਹ ਸਾਰਾ ਹੀ ਕੰਮ ਕੰਪਿਊਟਰ ਤੇ ਹੋਣ ਲੱਗ ਗਿਆ ਹੈ ਪਹਿਲਾਂ ਫਾਈਲ 'ਤੇ ਲਿਖਣ ਟਾਈਮ ਸਾਨੂੰ ਪਤਾ ਨਹੀਂ ਲੱਗਦਾ ਸੀ ਅਸੀਂ ਕਿਸੇ ਵੀ ਚੀਜ਼ ਨੂੰ ਦੁਬਾਰਾ ਰਪੀਟ ਕਰਕੇ ਕਰਕੇ ਲਿਖ ਦਿੰਦੇ ਹੈਂ ਜਾਂ ਫ਼ਿਰ ਗਲਤੀ ਗਲਤੀ ਕਰ ਦਿੰਦੇ ਹਾਂ ਤਾਂ ਸਾਨੂੰ ਪਤਾ ਨਹੀਂ ਲੱਗਦਾ ਅਤੇ ਕੋਈ ਵੀ ਚੀਜ਼ ਨੂੰ ਲੱਭਣ ਵਾਸਤੇ ਸਾਨੂੰ ਪੂਰੀ ਦੀ ਪੂਰੀ ਫਾਈਲ ਖੋਲ੍ਹਣੀ ਪੈਂਦੀ ਹੈ ਪਰ ਜਦ ਤੋਂ ਤੋਂ ਕੰਪਿਊਟਰ ਆਇਆ ਹੈ ਕੰਪਿਊਟਰ ਵਿੱਚ ਇੱਦਾਂ ਦੀਆਂ ਐਪਲੀਕੈਸ਼ਨਸ ਹੁੰਦੀਆਂ ਹਨ ਜਿਹੜੀਆਂ ਕਿ ਸਾਨੂੰ ਦੱਸ ਦਿੰਦੀਆਂ ਹੈ ਵੀ ਕਿਹੜੀ ਚੀਜ਼ ਆਪਾਂ ਦੁਬਾਰਾ ਲਿਖ ਤੀ ਹੈ ਅਤੇ ਕਿਸ ਵਿੱਚ ਕਿਆ ਗ਼ਲਤੀ ਹੈ ਜਾਂ ਫ਼ਿਰ ਸਾਨੂੰ ਕੋਈ ਚੀਜ਼ ਫਾਇੰਡ ਲੱਭਣੀ ਹੁੰਦੀ ਹੈ ਤਾਂ ਸਾਨੂੰ ਕੋਈ ਔਖੀ ਨਹੀਂ ਹੁੰਦੀ ਆਪਾਂ ਜਸਟ ਇੱਕ ਵਾਰੀ ਉਹਨੂੰ ਫਾਇੰਡ ਕਰਕੇ ਉਹ ਚੀਜ਼ ਲੱਭ ਸਕਦੇ ਹਾਂ ਅਤੇ ਇਸ ਕਾਰਨ ਕਾਫ਼ੀ ਚੀਜ਼ਾਂ ਵਿੱਚ ਸਾਨੂੰ ਬਹੁਤ ਫਾਇਦਾ ਫਾਇਦਾ ਹੋ ਰਿਹਾ ਹੈ ਜਿਸ ਕਾਰਨ ਸਾਡਾ ਕੰਮ ਅਸਾਨ ਅਤੇ ਜਲਦੀ ਹੋ ਰਿਹਾ ਹੈ ਅਤੇ ਇਸ ਦੇ ਨਾਲ਼ ਨਾਲ਼ ਹੀ ਸਾਡਾ ਜਿਹੜਾ ਡਾਟਾ ਹੈ ਉਹ ਸਕਿਓਰ ਹੋ ਰਿਹਾ ਹੈ ਕਿਉਂਕਿ ਕੰਪਿਊਟਰ ਵਿੱਚ ਡਾਟਾ ਖ਼ਰਾਬ ਹੋਣ ਰੱਦ ਹੋਣ ਦੀ ਗੱਲ ਨਹੀਂ ਹੁੰਦੀ ਅਤੇ ਇਸ ਵਿੱਚ ਸਾਡਾ ਡਾਟਾ ਸਕਿਓਰ ਰਹਿੰਦਾ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਟੈਮ ਆਪਾਂ ਆਪਣੇ ਕੋਲ਼ ਰੱਖ ਸਕਦੇ ਹੋ ਕਦੇ ਵੀ ਖ਼ਰਾਬ ਹੁੰਦਾ ਜਿੱਦਾਂ ਕਿ ਫ਼ਾਈਲ ਵਿੱਚ ਡਾਟਾ ਖ਼ਰਾਬ ਹੋ ਜਾਂਦਾ ਸੀ ਫ਼ਾਈਲਾਂ ਗਲ੍ਹ ਜਾਂਦੀਆਂ ਹੈ ਜਾਂ ਫ਼ਿਰ ਫ਼ਾਈਲਾਂ ਵਿੱਚ ਅੱਗ ਲੱਗਣਾ ਜਾਂ ਕੁਛ ਇੱਦਾਂ ਦਾ ਕੰਮ ਹੋ ਜਵੇ ਉਹ ਆਪਣੇ ਕੰਪਿਊਟਰ ਵਿੱਚ ਵੀ ਡਾਟਾ ਸੇਵ ਕਰ ਸਕਦੇ ਹਾਂ ਅਤੇ ਉਸ ਦੇ ਨਾਲ਼ ਨਾਲ਼ ਹੀ ਆਪਾਂ ਆਪਣਾ ਡਾਟਾ ਆਪਣੀ ਪੈਨਡ੍ਰਾਈਵ ਜਾਂ ਕਿਸੇ ਹੋਰ ਇੱਦਾਂ ਦੀ ਚੀਜ਼ ਵਿੱਚ ਵੀ ਸੇਵ ਕਰ ਸਕਦੇ ਹਾਂ ਕਿ ਇਨ ਕੇਸ ਜੇ ਸਾਡਾ ਡਾਟਾ ਕਿਤੇ ਡਿਲੀਟ ਹੋ ਜਾਵੇ ਜਾਂ ਸਾਡੇ ਤੋਂ ਗੁੰਮ ਜਵੇ ਤਾਂ ਆਪਾਂ ਉਸ ਡਾਟਾ ਨੂੰ ਦੁਬਾਰਾ ਰੀਸਟੋਰ ਕਰ ਸਕਦੇ ਹਾਂ ਜਿਵੇਂ ਕਿ ਕਈ ਵਾਰੀ ਸਰਵਰ ਵਿੱਚ ਪ੍ਰੋਬਲਮ ਆ ਜਾਂਦੀ ਹੈ ਪਰ ਆਪਣਾ ਡਾਟਾ ਆਪਾਂ ਜਿਵੇਂ ਕੀ ਈ ਮੇਲਸ ਵਗੈਰਾ ਤ ਸੇਵ ਕਰਕੇ ਰੱਖਦੇ ਹਾਂ ਤਾਂ ਉਸ ਵਿੱਚ ਸਾਨੂੰ ਆਪਣਾ ਡਾਟਾ ਦੁਬਾਰਾ ਲੈਣ ਦੀ ਇੱਕ ਸਹੂਲਤ ਮਿਲਦੀ ਹੈ ਜਿਸ ਕਰਕੇ ਆਪਣੇ ਬਿਜਨਸ ਬਹੁਤ ਹੀ ਬਹੁਤ ਹੀ ਵਧੀਆ ਚੱਲਦਾ ਹੈ ਅਤੇ ਕਈ ਵਾਰੀ ਆਪਾਂ ਆਪਣੀ ਐਡਵਰਟਾਇਜ਼ਮੈਂਟ ਵਗੈਰਾ ਵੀ ਕਰਦੇ ਹਾਂ ਵੀ ਆਪਣੇ ਬਿਜ਼ਨੈੱਸ ਬਾਰ ਬਿਜ਼ਨੈੱਸ ਬਾਰੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪਤਾ ਚੱਲਦਾ ਹੈ ਜਿਵੇਂ ਕਿ ਆਪਾਂ ਇੱਕ ਥਾਂ 'ਤੇ ਬਹਿ ਕੇ ਵੀ ਸ਼ੋਸ਼ਲ ਮੀਡੀਆ ਦੇ ਰਾਹੀਂ ਆਪਣੇ ਬਿਜ਼ਨੈੱਸ ਨੂੰ ਹੋਰ ਅੱਗੇ ਤੋਂ ਅੱਗੇ ਵਧਾ ਸਕਦੇ ਹੋ ਅਤੇ ਹੋਰ ਲੋਕਾਂ ਤੱਕ ਪਹੁੰਚਾ ਸਕਦੇ ਓਂ